ਪੁਰਾਤਨ ਸਮੇਂ ਦੇ ਵਿੱਚ ਪੰਜਾਬੀ ਦੇ ਵਿੱਚ ਬੜੇ ਸ਼ਬਦ ਹੁੰਦੇ ਸਨ ਅਤੇ ਹੁਣ ਵਾਲੇ ਸਮੇਂ ਦੇ ਵਿੱਚ ਉਹਨਾਂ ਸ਼ਬਦਾਂ ਨੂੰ ਕੋਲਜਾਂ ਅਤੇ ਯੂਨੀਵਰਸਿਟੀਆਂ ਵੱਲੋਂ ਸ ਰਿਸਰਚ ਕਰ ਕੇ ਉਹਨਾਂ ਵਿੱਚ ਤਬਦੀਲੀਆਂ ਕੀਤੀਆਂ ਜਾ ਰਹੀਆਂ ਜਿਵੇਂ ਕਿ ਪਹਿਲਾਂ ਪੰਜਾਬੀ ਦੇ ਵਿੱਚ ਅੱਖਰ ਜ਼ਿਆਦਾ ਹੁੰਦੇ ਸਨ ਹੁਣ ਜਿਵੇਂ ਪੰਜਾਬੀ ਯੂਨੀਵਰਸਿਟੀ ਨੇ ਕਾਫੀ ਸਾਰੇ ਅੱਖਰ ਜਿਹਨਾਂ ਦੀ ਕੋਈ ਆਵਾਜ਼ ਨਹੀਂ ਆ ਰਹੀ ਜਾਂ ਕੋਈ ਅੱਧੇ ਹੁੰਦੇ ਹਨ ਉਹਨਾਂ ਨੂੰ ਹਟਾ ਦਿੱਤਾ ਗਿਆ ਹੈ ਮੈਂ ਆਪਣੇ ਪੰਜਾਬੀ ਦੇ ਪੜ੍ਹਨ ਵਿੱਚ ਵੀ ਬੜੇ ਤਬਦੀਲੀ ਦੇਖ ਰਿਹਾ ਹਾਂ ਕਿਉਂਕਿ ਇੱਕ ਤਾਂ ਸੁਸਾਇਟੀ ਬਦਲਣ ਦੇ ਨਾਲ ਪੰਜਾਬੀ ਬੋਲਣ ਦੇ ਵਿੱਚ ਭਾਸ਼ਾ ਵਿਕਸਿਤ ਹੋਈ ਹੈ ਅਲੱਗ ਅਲੱਗ ਲੋਕਾਂ ਦੇ ਪੰਜਾਬ ਵਿੱਚ ਆਉਣ ਦੇ ਨਾਲ ਵੀ ਭਾਸ਼ਾ ਵਿਕਸਿਤ ਹੋਈ ਹੈ